ਹੈਲੋ ਨਮਸ਼ਕਾਰ ਜੀ ਮੇਰੇ ਘਰ ਵਿਆਹ ਹੈਗਾ ਮੇਰੇ ਬਰਦਰ ਦਾ ਭਰਾ ਮੇਰੇ ਦਾ ਵੱਡੇ ਦਾ ਉਹਦੇ ਵਾਸਤੇ ਮੈਨੂੰ ਮਿਠਾਈ ਦਾ ਇੰਤਜਾਮ ਕਰਨਾ ਮੈਂ ਉਹਦੇ ਵਾਸਤੇ ਮੈਨੂੰ ਹਲਵੇ ਦੀ ਜ਼ਰੂਰਤ ਹੈ ਹਲਵਾ ਚਾਹੀਦਾ ਹੈ ਫਿਰ ਲੱਡੂ ਵਗੈਰਾ ਚਾਹੀਦੇ ਹੈ ਉਹਦੇ ਵਾਸਤੇ ਮੈਨੂੰ ਵਧੀਆ ਦੇਸੀ ਘਿਓ ਦੀ ਮਿਠਾਈ ਚਾਹੀਦੀ ਹੈ ਜੋ ਕਿ ਵਧੀਆ ਕੁਆਲਿਟੀ ਦੀ ਹੋਵੇ ਕੋਈ ਉਲਾਂਭਾ ਨਾ ਹੋਵੇ ਵਿੱਚ ਪੈਸੇ ਕਿੰਨੇ ਦੇ ਆਉਣੇ ਮਤਲਬ ਕਿ ਲੈਸ ਪੂਰੀ ਮਿਲਣੀ ਚਾਹੀਦੀ ਹੈ ਮੈਨੂੰ ਮੈਂ ਸਾਰੇ ਹੋਟਲਾਂ 'ਚ ਪਤਾ ਕਰ ਲਿਆ ਆ ਅਤੇ ਤੁਹਾਡਾ ਵੀ ਰੇਟ ਮੈਂ ਜਾਣਨਾ ਚਾਹੁੰਦਾ ਹਾਂ ਕੇ ਕੀ ਰੇਟ ਹੈਗਾ ਤੁਹਾਡਾ ਕੀ ਨਹੀਂ ਹੈਗਾ ਵਧੀਆ ਮਿਠਾਈ ਚਾਹੀਦੀ ਹੈ ਮੈਨੂੰ ਵਧੀਆ ਮਿਠਾਈ ਮਿੱਠਾ ਵਧੀਆ ਹੋਣਾ ਚਾਹੀਦਾ ਆ ਜਾ ਜੇ ਸਸਤਾ ਅੋਫਰ ਮੈਨੂੰ ਚਾਹੀਦੀ ਹੈ ਕੀ ਅੋਫਰ ਜੇ ਤੁਸੀਂ ਅੋਫਰ ਮੈਨੂੰ ਦੇਵੋਗੇ ਤਾਂ ਮੈਂ ਤੁਹਾਡੇ ਨਾ ਨਾਲ ਹੀ ਡਿਸਕਸ ਕਰਾਂਗਾ ਤੁਹਾਡੇ ਕੋਲ ਹੀ ਲਵਾਂਗਾ ਅਤੇ ਕੋਈ ਗਿਫਟ ਵਗੈਰਾ ਵੀ ਹੋਵੇਗਾ ਨਾਲ ਤਾਂ ਉਹ ਵੀ ਕਰੋਗੇ ਸਾਨੂੰ ਤਾਂ ਅਸੀਂ ਤੁਹਾਡੇ ਕੋਲ ਜ਼ਰੀਆ ਵਧੀਆ ਚੀਜ਼ਾਂ ਲਵਾਂਗੇ ਤੁਹਾਡੇ ਕੋਲ ਹੋਰ ਵੀ ਕੋਈ ਚੀਜ਼ ਪਸੰਦ ਕਰਾਂਗੇ ਲੈਣ ਦੀ ਕਰਾ ਪੇਮੈਂਟ ਕਿੰਨੀ ਹੈ ਜੋ ਵੀ ਹੈ ਉਹ ਸਾਰਾ ਸਾਨੂੰ ਦੱਸੋ ਬਿਲ ਬਣਾ ਕੇ ਜੇ ਸਾਨੂੰ ਸਸਤਾ ਲੱਗੇਗਾ ਟਿਕਾਊ ਲੱਗੇਗਾ ਹਰ ਚੀਜ਼ ਵਧੀਆ ਲੱਗੇਗੀ ਤਾਂ ਅਸੀਂ ਤੁਹਾਡੇ ਕੋਲੋਂ ਹੀ ਚੀਜ਼ ਲਵਾਂਗੇ ਹੋਰ ਕਿਤੋਂ ਅਸੀਂ ਕਿਤੋਂ ਨਹੀਂ ਪਤਾ ਕਰਾਂਗੇ ਤਿੰਨ ਚਾਰ ਜਗ੍ਹਾ ਅਸਾਂ ਪਹਿਲਾਂ ਪਤਾ ਕਰ ਚੁੱਕੇ ਹਾਂ ਹੋਰ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਇਹ ਮੈਨੂੰ ਪਤਾ ਕਰਕੇ ਦੱਸੋ ਪੂਰਾ ਜੀ ਓਕੇ